ਹੈਲੋ ਮੈਂ ਸ਼ਿਵਾਨਾ ਪਿੰਡ ਬੱਪੀਆਂ ਰਹਿਣ ਵਾਲੀ ਹਾਂ ਮੈਂ ਪਹਿਲਾਂ ਤੁਹਾਨੂੰ ਇਗਜ਼ਾਮ ਸੀਗਾ ਮੇਰਾ ਮੈਂ ਕੈਬ ਬੁੱਕ ਕੀਤੀ ਸੀਗੀ ਤੁਹਾਡੇ ਵੱਲੋਂ ਬਟ ਮੈਂ ਪੇਪਰ ਦੇਣਾ ਨਹੀਂ ਚਾਹੁੰਦੀ ਸੀਗੀ ਕਿਉਂਕਿ ਮੌਸਮ ਬਹੁਤ ਹੀ ਜ਼ਿਆਦਾ ਖਰਾਬ ਹੋ ਗਿਆ ਸੀ ਜਿਸ ਕਰਕੇ ਮੇਰੇ ਤੋਂ ਪੇਪਰ ਜਾ ਰਿਹਾ ਸੀਗਾ ਇਸ ਕਰਕੇ ਮੈਂ ਤੁਹਾਡੇ ਤੋਂ ਜਿਹੜੀ ਕੈਬ ਆ ਗਈ ਕੈਬ ਦੇ ਵਿੱਚ ਐਡਵਾਂਸ ਜਿਹੜੀ ਰਕਮ ਸੀਗੀ ਉਹ ਲੈਣਾ ਚਾਹੁੰਦੀ ਹਾਂ ਜਿਹੜੀ ਰਕਮ ਮੈਂ ਪੇ ਤੁਸੀਂ ਜਾਂ ਤਾਂ ਮੈਨੂੰ ਪੇਮੈਂਟ ਕਰ ਦਿਓ ਨਹੀਂ ਤਾਂ ਗੂਗਲ ਨਹੀਂ ਤਾਂ ਗੂਗਲ ਪੇ 'ਤੇ ਭੇਜ ਦਿਓ ਨਹੀਂ ਤੁਸੀਂ ਮੇਰੇ ਉਹ ਪੈਸੇ ਖਾਤੇ ਦੇ ਵਿੱਚ ਪਾ ਸਕਦੇ ਹੋ